ਪੰਛੀਆਂ ਨੂੰ ਮੈਂ ਅਲੱਗ ਅਲੱਗ ਚੀਜ਼ਾਂ ਖਾਂਦੇ ਹੋਏ ਦੇਖਿਆ ਹੈ ਤੋਤਾ ਜਿਵੇਂ ਹਰੀ ਮਿਰਚ ਖਾਂਦਾ ਹੈ ਅਤੇ ਚਿੜੀਆਂ ਚੂਰੀ ਕ ਚਿੜੀਆਂ ਰੋਟੀ ਖਾਂਦੀਆਂ ਹਨ ਅਤੇ ਕਬੂਤਰ ਬਾਜਰਾ ਖਾਂਦੇ ਹਨ ਅਤੇ ਕ ਗਾਵਾਂ ਘ ਘਾਹ ਅਤੇ ਗਾਵਾਂ ਘਾ ਘਾਹ ਫੂਸ ਖਾਂਦੀਆਂ ਹਨ ਬੱਕਰੀਆਂ ਵੀ ਘਾਹ ਖਾਂਦੀਆਂ ਹਨ ਮੈਨੂੰ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਬੜਾ ਲਗਾਵ ਹੈ ਮੈਂ ਆਪਣੀ ਛੱਤ 'ਤੇ ਸਵੇਰੇ ਉੱਠ ਕੇ ਬਾਜਰਾ ਪਾਉਂਦੀ ਹਾਂ ਮੈਨੂੰ ਇਹ ਬੜਾ ਚੰਗਾ ਲੱਗਦਾ ਹੈ ਮੈਂ ਇਹ ਆਪਣੀ ਦਾਦੀ ਕੋਲੋਂ ਸਿੱਖਿਆ ਹੈ ਕ ਸਿੱਖ ਸਿੱਖਿਆ ਹੈ ਕਿ ਦਾਦੀ ਜੀ ਮੇਰੇ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਦਾਣਾ ਪਾਉਂਦੇ ਸਨ ਅਤੇ ਮੈਂ ਵੀ ਉਹਨਾਂ ਨੂੰ ਵੇਖ ਕੇ ਰੋਜ਼ ਬਾਜ ਪਾਉਂਦੀ ਹਾਂ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਮੈਂ ਬੜੀ ਖੁਸ਼ ਹੁੰਦੀ ਹਾਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਮੈਂ ਵੀ ਕੁਛ ਕਰ ਪਾਉਂਦੀ ਹਾਂ ਇਹਨਾਂ ਪੰਛੀਆਂ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਛੀਆਂ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਪੰਛੀਆਂ ਨੂੰ ਖਾਣ ਪੀਣ ਨੂੰ ਦੇਣਾ ਚਾਹੀਦਾ ਹੈ ਪਾਣੀ ਕਈ ਪੰਛੀਆਂ ਨੂੰ ਮੈਂ ਪਾਣੀ ਵੀ ਪਾਉਂਦੀ ਹਾਂ ਡੌਂਗੇ ਵਿੱਚ ਅਤੇ ਉਹਨਾਂ ਨੂੰ ਪੀਣ ਲਈ ਰੱਖ ਦਿੰਦੀ ਹਾਂ ਕਿ ਸਵੇਰੇ ਉੱਠ ਕੇ ਉਹ ਪਾਣੀ ਵੀ ਪੀ ਲੈਣ ਅਤੇ ਬਾਜਰਾ ਵੀ ਖਾ ਲੈਣ ਅਤੇ ਨਾਲ ਨਿੱਕੀ ਛੋਟੇ ਛੋਟੇ ਚਾਵਲਾਂ ਦੇ ਦਾਣੇ ਵੀ ਪਾ ਦਿੰਦੀ ਹਾਂ ਮੱਕੀ ਦੇ ਦਾਣੇ ਵੀ ਪਾਉਂਦੀ ਹਾਂ ਕਿ ਉਹ ਖਾ ਪੀ ਲੈਣ ਅਤੇ ਉਹਨਾਂ ਨੂੰ ਰੱਜ ਆ ਜਾਵੇ ਇਹਨਾਂ ਨੂੰ ਅਸੀਂ ਲੋਕ ਹੀ ਦੇਖਾਂਗੇ ਧੰਨਵਾਦ